ਜਦ ਮੈਂ ਕ ਕੋਲਜ ਫਸਟ ਈਅਰ ਵਿੱਚ ਸੀ ਤਦ ਆਈ ਆਈ ਟੀ ਵਿੱਚ ਇੱਕ ਕੋਪੀਟੀਸ਼ਨ ਔਰਗਨਾਈਜ਼ ਕੀਤਾ ਗਿਆ ਸੀ ਜਿਸ ਦਾ ਟੋਪਿਕ ਸੀਗਾ ਕਿ ਵੂਮੈਨਸ ਡੇ ਉਸ ਵਿੱਚ ਮੈਂ ਵੂਮੈਨਸ ਦੇ ਰਿ ਦੇ ਰਿਲੇਟਿਡ ਇੱਕ ਪੇਂਟਿੰਗ ਬਣਾਈ ਸੀ ਜਿਸ ਵਿੱਚ ਵੂਮੈਨਸ ਵੂਮੈਨਸ ਨੂੰ ਕਿੱਦਾਂ ਅੱਗੇ ਬੜਾਇਆ ਜਾ ਸਕਦਾ ਹੈ ਉਹ ਸ਼ੋਅ ਕੀਤਾ ਸੀ ਅਤੇ ਉਸ ਵਿੱਚ ਮੇਰਾ ਸੈਕਿੰਡ ਪ੍ਰਾਈਜ਼ ਆਇਆ ਸੀ ਅਤੇ ਉੱਥੇ ਦੇ ਜੱਜਿਸ ਤੋਂ ਮੈਂ ਇੰਨਾਂ ਜ਼ਿਆਦਾ ਪ੍ਰਭਾਵਿਤ ਉਹਨਾਂ ਨੇ ਪ੍ਰਭਾਵਿਤ ਕੀਤਾ ਸੀ ਕਿ ਅਸੀਂ ਉ ਉਸ ਪ੍ਰਸ਼ੰਸਾ ਨੂੰ ਲੈ ਕੇ ਅਸੀਂ ਆਪਣੀਆਂ ਕਲਾਸਿਸ ਸ਼ੁਰੂ ਕੀਤੀਆਂ ਜਿਸ ਵਿੱਚ ਅਸੀਂ ਬੱਚਿਆਂ ਦਾ ਸਮਰ ਕੈਂਪ ਔਰਗਨਾਈਜ਼ ਕੀਤਾ ਗਿਆ ਸੀ ਅਤੇ ਜਿਸ ਵਿੱਚ ਸਾਨੂੰ ਕਾਫੀ ਜ਼ਿਆਦਾ ਮਜ਼ਾ ਵੀ ਆਇਆ ਅਤੇ ਬੱਚਿਆਂ ਨੂੰ ਵੀ ਕਾਫੀ ਪਸੰਦ ਆਇਆ ਔਰ ਮੈਨੂੰ ਵੈਸੇ ਤਾਂ ਸਾਰੀਆਂ ਹੀ ਜ਼ਿਆਦਾਤਰ ਹਰ ਕਲਾ ਦੇ ਬਾਰੇ ਥੋੜ੍ਹੀ ਬਹੁਤੀ ਜਾਣਕਾਰੀ ਹੈ ਪਰ ਮੇਰਾ ਗਲਾਸ ਪੇਂਟਿੰਗ ਸਿੱਖਣ ਵਿੱਚ ਕਾਫ਼ੀ ਜ਼ਿਆਦਾ ਉਹ ਰੁਚੀ ਹੈ ਜੋ ਕਿ ਇੱਥੇ ਸਿਖਾਈ ਨਹੀਂ ਜਾਂਦੀ ਪਰ ਮੈਂ ਬਹੁਤ ਜ਼ਿਆਦਾ ਓਹਨੂੰ ਸਿੱਖਣਾ ਚਾਹੁੰਦੀ ਹਾਂ ਅਗਰ ਮੈਨੂੰ ਗਲਾਸ ਪੇਂਟਿੰਗ ਸਿੱਖਣ ਦਾ ਮੌਕਾ ਮਿਲੇ ਤਾਂ ਮੈਂ ਜ਼ਰੂਰ ਸਿੱਖਾਂਗੀ